ਹਾਂਜੀ ਮੈਂ ਬਹੁਤ ਵਾਰ ਕੱਪੜੇ 'ਤੇ ਕਢਾਈ ਕੀਤੀ ਹੈ ਅਤੇ ਕਢਾਈ ਕਰਨ ਲਈ ਸਾਨੂੰ ਸਿਲਕ ਦਾ ਐਂਕਰ ਦਾ ਧਾਗਾ ਵਰਤਣਾ ਚਾਹੀਦਾ ਹੈ ਜੋ ਕਿ ਬਹੁਤ ਹੀ ਵਧੀਆ ਹੁੰਦਾ ਹੈ ਖਾਸ ਤੌਰ 'ਤੇ ਉਸ ਦੀ ਸਫਾਈ ਬਹੁਤ ਹੀ ਵਧੀਆ ਆਉਂਦੀ ਹੈ ਜਿਸ ਨੂੰ ਅਸੀਂ ਹਰ ਤਰ੍ਹਾਂ ਦੇ ਕੱਪੜੇ 'ਤੇ ਵੀ ਵਰਤ ਸਕਦੇ ਹਾਂ ਜਿੱਦਾਂ ਅਸੀਂ ਸੂਟਾਂ ਦੇ ਉੱਪਰ ਹਰ ਤਰ੍ਹਾਂ ਦੀ ਕਢਾਈ ਵਾਸਤੇ ਹੀ ਕੁਛ ਕਰ ਸਕਦੇ ਹਾਂ ਅਸੀਂ ਹਰ ਤਰ੍ਹਾਂ ਦੇ ਡਿਜ਼ਾਈਨ ਜਿਵੇਂ ਕਿ ਤਿਤਲੀਆਂ ਫੁੱਲ ਪੱਤੇ ਹੋਰ ਵੀ ਕਈ ਤਰ੍ਹਾਂ ਦੇ ਡਿਜ਼ਾਇਨ ਪੈਚ ਵਰਕ ਘੇਰੇ 'ਤੇ ਬਾਹਾਂ ਦੇ ਗਲੇ 'ਤੇ ਕਾਲਰ 'ਤੇ ਚੁੰਨੀਆਂ 'ਤੇ ਹਰ ਤਰ੍ਹਾਂ ਦੀ ਕਢਾਈ ਵਿੱਚ ਇਹੀ ਧਾਗਾ ਵਰਤਿਆ ਜਾਂਦਾ ਹੈ ਔਰ ਇਸ ਨੂੰ ਮਸ਼ੀਨ ਨਾਲ ਵੀ ਵਰਤਿਆ ਜਾ ਸਕਦਾ ਹੈ ਮਸ਼ੀਨੀ ਕਢਾਈਆਂ ਦੇ ਉੱਤੇ ਇਸ ਨੂੰ ਵਰਤਿਆ ਜਾ ਸਕਦਾ ਹੈ ਹੱਥ ਦੀ ਕਢਾਈ ਵਿੱਚ ਵੀ ਇਹ ਫਰੇਮ ਲਗਾ ਕੇ ਕਢਾਈ ਕੀਤੀ ਜਾਂਦੀ ਹੈ ਬਹੁਤ ਹੀ ਸਫਾਈ ਨਾਲ ਇਸ ਦਾ ਕੰਮ ਕੀਤਾ ਜਾਂਦਾ ਹੈ ਬਹੁਤ ਸੋਹਣਾ ਲੱਗਦਾ ਹੈ ਬਹੁਤ ਹੀ ਸੂਟਾਂ ਦੇ ਸਲਵਾਰਾਂ ਦੇ ਪੌਂਂਚਿਆਂ 'ਤੇ ਵੀ ਇਸ ਦਾ ਕੰਮ ਬਹੁਤ ਹੀ ਸੋਹਣਾ ਲੱਗਦਾ ਹੈ ਧੰਨਵਾਦ